ਹਾਂ ਇਹ ਸੱਚ ਹੈ ਕਿ ਸਾਡਾ ਭਾਰਤ ਬਹੁਤ ਹੀ ਸੁੰਦਰ ਅਤੇ ਖੁਸ਼ਹਾਲ ਖੁਸ਼ਹਾਲ ਹੈ ਜੋ ਕਿ ਭਾਰਤ ਵਿੱਚ ਬਹੁਤ ਹੀ ਇਹੋ ਜਿਹੀਆਂ ਥਾਵਾਂ ਹਨ ਜੋ ਕਿ ਅੱਜ ਕੱਲ੍ਹ ਸਮੇਂ ਦੇ ਨਾਲ ਬਦਲਦੀਆਂ ਜਾ ਰਹੀਆਂ ਹਨ ਅਤੇ ਇਸ ਵਿੱਚ ਹਾਂ ਅਤੇ ਜਲੰਧਰ ਜ ਸਾਇੰਸ ਸਿਟੀ ਹੈ ਉਸ ਵਿੱਚ ਹਾਂ ਬੱਚਿਆਂ ਨੂੰ ਬਹੁਤ ਸਿੱਖਿਆ ਦਿੱਤੀ ਜਾਂਦੀ ਹੈ ਉੱਥੇ ਇੱਕ ਗਲੋ ਹੈ ਅਤੇ ਉਹ ਧਰਤੀ ਦੁਆਰਾ ਘੁਮ ਘੁਮਾਇਆ ਜਾਂਦਾ ਹੈ ਅਤੇ ਉਸ ਵਿੱਚ ਬਹੁਤ ਹੀ ਸਿੱਖਿਆ ਦਿੱਤੀ ਜਾਂਦੀ ਹੈ ਜਿਵੇਂ ਕਿ ਅੜੀਸਰ ਸਾਹਿਬ ਹੈ ਉੱਥੇ ਬੋ ਇੱਛਾ ਪੂਰੀ ਕੀਤੀ ਜਾਂਦੀ ਹੈ ਲੋਕਾਂ ਦੇ ਦੂਰੋਂ ਦੂਰੋਂ ਦੇਖਣ ਆਉਂਦੇ ਹਨ ਅਤੇ ਉਹਦੀ ਉਹ ਕਰਨ ਸ਼ ਉਹ ਕਰਨ ਆਉਂਦੇ ਹਨ ਅਤੇ ਜਿਵੇਂ ਕਿ ਚੰਡੀਗੜ੍ਹ ਸ ਸਿ ਚੰਡੀਗੜ੍ਹ ਸਿਟੀ ਹੈ ਉਹਦੇ ਵਿੱਚ ਛੱਤੀਸ ਛੱਤੀਸਗੜ੍ਹ ਜਿਵੇਂ ਕਿ ਉੱਥੇ ਜਾਨਵਰ ਰਹਿੰਦੇ ਹਨ ਹਾਂ ਅਤੇ ਵੱਖ ਵੱਖ ਅਲੱਗ ਅਲੱਗ ਜਾਨਵਰਾਂ ਦੀਆਂ ਥਾਂ ਰੱਖੀਆਂ ਗਈਆਂ ਹਨ ਅਤੇ ਉੱਥੇ ਵੀ ਬੱਚਿਆਂ ਨੂੰ ਲੈ ਕੇ ਜਾਂਦੇ ਹਨ ਅਤੇ ਉਹਨਾਂ ਨੂੰ ਵੀ ਸਿੱਖ ਸਿੱਖਿਆ ਦਿੱਤੀ ਜਾਂਦੀ ਹੈ ਜਿਵੇਂ ਕਿ ਰਾਕ ਗਾਰਡਨ ਵਿਚ ਹਾਂ ਅਤੇ ਰੋਜ਼ ਗਾਰਡਨ ਬਹੁਤ ਸਾਰੇ ਰੋਜ਼ ਵੀ ਅਲੱਗ ਅਲੱਗ ਦੇ ਤਰ੍ਹਾਂ ਦੇ ਹੁੰਦੇ ਹਨ ਅਤੇ ਉੱਥੇ ਉਹਨਾਂ ਦੀ ਖੁਸ਼ਬੂ ਬਹੁਤ ਹੀ ਖੁਸ਼ਹਾਲ ਹੁੰਦੀ ਵਧੀਆ ਹੁੰਦੀ ਹੈ ਅਤੇ ਕਹਿੰਦੇ ਝੀਲ ਵਿੱਚ ਹਾਂ ਉੱਥੇ ਇੱਕ ਝੀਲ ਵੀ ਹੈ ਅਤੇ ਉਹਦੇ ਵਿੱਚ ਅਤੇ ਕਹਿੰਦੇ ਨੇ ਕਿਸ਼ਤੀਆਂ ਚੱਲਦੀਆਂ ਹਨ ਅਤੇ ਬੱਚਿਆਂ ਨੂੰ ਬਹੁਤ ਹੀ ਨਜ਼ਾਰਾ ਦਵਾਇਆ ਜਾਂਦਾ ਹੈ ਅਤੇ ਉੱਥੇ ਸਿੱਖਿਆ ਦਿੱਤੀ ਜਾਂਦੀ ਹੈ ਸਾਡੇ ਸਾਡੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਿਨਮੇ ਵੀ ਬਹੁਤ ਬਣੇ ਹੋਏ ਹਨ ਵਿੱਚ ਲੋਕ ਹਾਂ ਫਿਲਮਾਂ ਦੇਖਣ ਜਾਂਦੇ ਹਨ ਅਤੇ ਆਪਣਾ ਮਨੋਰੰਜਨ ਕਰਦੇ ਹਨ ਅਤੇ ਜਿਵੇਂ ਕਿ ਹਾਂ ਸਾਡੇ ਪਿੰਡ ਇੱਕ ਆਉਟਲੈਟ ਵੀ ਬਣਿਆ ਹੋਇਆ ਹੈ ਉਸ ਵਿੱਚ ਜੋ ਤੁਹੀ ਜੋ ਵੀ ਬਹੁਤ ਹੀ ਵੱਡਾ ਹੈ ਅਤੇ ਬਹੁਤ ਹੀ ਵਧੀਆ ਹੈ ਅਤੇ ਉੱਥੋਂ ਦੇ ਲੋਕ ਉੱਥੋਂ ਦੂਰੋਂ ਦੂਰੋਂ ਦੇਖਣ ਆਉਂਦੇ ਹਨ ਅਤੇ ਉਹ ਉੱਥੇ ਫੋਟੋਗ੍ਰਾਫੀ ਵੀ ਖਿੱਚਦੇ ਹਨ ਅਤੇ ਕਹਿੰਦੇ ਹੁੰਦੇ ਨੇ ਬਹੁਤ ਹੀ ਜ਼ਿਆਦਾ ਮਸ਼ਹੂਰ ਵੀ ਹੈ ਅਤੇ ਪੰਜਾਬ ਪਹਿਲਾਂ ਵਾਂਗੂ ਨਹੀਂ ਰਿਹਾ ਅਤੇ ਸਮੇਂ ਦੇ ਸਮੇਂ ਨਾਲ ਬਦਲਦਾ ਜਾ ਰਿਹਾ ਹੈ